ਪਹਿਲਾਂ ਅਸੀਂ ਪਹਿਲਾਂ ਅਸੀਂ ਛੋਟੀਆਂ ਛੋਟੀਆਂ ਯਾਤਰਾ 'ਤੇ ਘੁੰਮਣ ਜਾਂਦੇ ਸੀ ਘੁੰਮਣ ਜਾਂਦੇ ਸੀ ਅਤੇ ਉਸ ਤੋਂ ਬਾਅਦ ਅਸੀਂ ਲੰਬੀ ਯਾਤਰਾ 'ਤੇ ਜਾਣ ਦਾ ਪਲਾਇਨ ਬਣਾਇਆ ਪਰ ਮੈਨੂੰ ਬਹੁਤ ਡਰ ਲੱਗਦਾ ਸੀ ਇਸ ਸਾਡੇ ਰਿਸ਼ਤੇਦਾਰਾਂ ਨੇ ਮੈਨੂੰ ਉਤਸ਼ਾਹ ਕੀਤਾ ਵਈ ਮ ਹੌਸਲਾ ਦਿੱਤਾ ਵੀ ਆਪਾਂ ਲੰਬੀ ਯਾਤਰਾ 'ਤੇ ਜਾਂਦੇ ਹਾਂ ਕੋਈ ਪ੍ਰੋਬਲਮ ਨਹੀਂ ਆਊਗੀ ਕੁਛ ਨਹੀਂ ਹੋਊਗਾ ਇਸ ਕਰਕੇ ਫੇਰ ਅਸੀਂ ਹੇਮਕੁੰਟ ਸਾਹਿਬ ਜਾਣ ਦੀ ਸਲਾਹ ਬਣਾਈ ਫੇਰ ਅਸੀਂ ਹੇਮਕੁੰਟ ਸਾਹਿਬ ਗਏ ਹੇਮਕੁੰਟ ਸਾਹਿਬ ਦੀ ਯਾਤਰਾ ਬਹੁਤ ਕਠਿਨ ਸੀ ਅਤੇ ਮੁਸ਼ਕਲ ਬਹੁਤ ਮੁਸ਼ਕਲ ਸੀ ਅਤੇ ਫੇਰ ਵੀ ਅਸੀਂ ਹੌਸਲਾ ਨਹੀਂ ਛੱਡਿਆ ਰਸਤੇ ਵਿੱਚ ਬਹੁਤ ਉੱਚੀਆਂ ਪਹਾੜੀਆਂ ਬਰਫ਼ ਵਾਲੀਆਂ ਪਹਾੜੀਆਂ ਕਰਦੇ ਕਰਾਉਂਦੇ ਅਸੀਂ ਮਤਲਬ ਕਿ ਸੰਗਤਾਂ ਨੂੰ ਮਿਲੇ ਥੋੜ੍ਹਾ ਥੋੜ੍ਹਾ ਅਸੀਂ ਜਦ ਸਾਹ ਚੜ੍ਹ ਜਾਂਦਾ ਸੀ ਅਸੀਂ ਥੋੜ੍ਹਾ ਜਿਹਾ ਅਰਾਮ ਕੀਤਾ ਅਤੇ ਅਰਾਮ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਪ੍ਰੋਬਲਮ ਆਈ ਤੁਰਨ ਦੇ ਨਾਲ ਹੈ ਨਾ ਸਾਹ ਦੀ ਵੀ ਪ੍ਰੋਬਲਮ ਥੋੜ੍ਹੀ ਜਿਹੀ ਆਉਂਦੀ ਸੀਗੀ ਅਤੇ ਉਹ ਰਸਤੇ ਵਿੱਚ ਅਸੀਂ ਕਪੂਰ ਨੂੰ ਸੁੰਘਦੇ ਗਏ ਕਿਸੇ ਨੇ ਸਾਨੂੰ ਮਤਲਬ ਸਲਾਹ ਦਿੱਤੀ ਕਿ ਹੱਥ ਵਿੱਚ ਕਪੂਰ ਦੀ ਟਿੱਕੀ ਲੈ ਕੇ ਕਪੂਰ ਨੂੰ ਸੁੰਘਦੇ ਜਾਓ ਉਹਦੇ ਨਾਲ ਤੁਹਾਨੂੰ ਸਾਹ ਨਹੀਂ ਚੜ੍ਹੇਗਾ ਸਾਹ ਸਾਹ ਸੌਖਾ ਆਊਗਾ ਰਸਤੇ ਵਿੱਚ ਸਾਹ ਸੌਖਾ ਆਊਗਾ ਅਤੇ ਨਾਲ ਅਸੀਂ ਗੁਲੂਕੋਸ਼ ਦਾ ਪਾਣੀ ਵੀ ਲੈ ਗਏ ਰਸਤੇ ਵਿੱਚ ਘੋਲ ਘੋਲ ਕੇ ਪਾਣੀ ਪੀਂਦੇ ਗਏ ਅਤੇ ਯਾਤਰਾ ਬਹੁਤ ਕਠਿਨ ਸੀਗੀ ਅਤੇ ਇਸ ਕਰਕੇ ਓ ਇਸ ਕਰਕੇ ਜਦੋਂ ਅਸੀਂ ਹੇਮਕੁੰਟ ਸਾਹਿਬ ਪੁੱਜੇ ਅਤੇ ਦਰਸ਼ਨ ਕੀਤੇ ਬਹੁਤ ਵਧੀਆ ਲੱਗਿਆ ਸਾਨੂੰ ਅਤੇ ਜਦੋਂ ਅਸੀਂ ਵਾਪਸ ਆਏ ਵਾਪਸ ਆਉਣ ਮਗਰੋਂ ਵਾਪਸ ਆਉਣ ਮਗਰੋਂ ਮੇਰੇ ਸਾਹ ਫੁੱਲਣ ਲੱਗ ਗਏ ਇਸ ਕਰਕੇ ਅਸੀਂ ਡੋਕਟਰ ਸਾਹਿਬ ਨੂੰ ਆ ਕੇ ਡੋਕਟਰ ਸਾਹਿਬ ਨੀਚੇ ਆ ਕੇ ਡੋਕਟਰ ਸਾਹਿਬ ਨੂੰ ਮਿਲੇ ਡਾਕਟਰ ਸਾਹਿਬ ਨੇ ਦੱਸਿਆ ਕਿ ਕੋਈ ਗੱਲ ਨਹੀਂ ਠੀਕ ਹੋ ਜਾਵੋਂਗੇ ਤੁਸੀਂ ਵੀ ਐਨੀ ਕਠਿਨ ਯਾਤਰਾ ਕਰਨਾ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਅਤੇ ਡੋਕਟਰ ਸਾਹਿਬ ਨੇ ਮੇਰੀਆਂ ਸਾਰੀਆਂ ਦਵਾਈਆਂ ਚੈੱਕ ਕੀਤੀਆਂ ਅਤੇ ਮੈਨੂੰ ਹੱਸਣ ਲਈ ਖੁਸ਼ ਹੋਣ ਲਈ ਕਿਹਾ ਵੀ ਹੱਸੋ ਤੁਸੀਂ ਖੁਸ਼ ਰਹੋ ਫੇਰ ਮੈਂ ਡੋਕਟਰ ਸਾਹਿਬ ਨੂੰ ਦੱਸਿਆ ਕਿ ਡੋਕਟਰ ਸਾਹਿਬ ਦ ਡਾਕਟਰ ਸਾਹਿਬ ਨੂੰ ਦੱਸਿਆ ਉਨ੍ਹਾਂ ਨੇ ਕਿਹਾ ਜਦੋਂ ਤੁਸੀਂ ਸਵੇਰੇ ਜਾਓਂਗੇ ਚੜ੍ਹੋਂਗੇ ਪਹਾੜ ਹੈ ਨਾ ਵੀ ਉਦੋਂ ਤੁਸੀਂ ਇਹ ਓ ਐੱਸ ਦਾ ਘੋਲ ਪੀਂਦੇ ਜਾਣਾ ਅਤੇ ਮੈਂ ਡੋਕਟਰ ਸਾਹਿਬ ਨੂੰ ਦੱਸਿਆ ਕਿ ਅਸੀਂ ਤਾਂ ਦਰਸ਼ਨ ਕਰ ਚੁੱਕੇ ਹਾਂ ਚੜ੍ਹਾਈ ਚੜ੍ਹ ਚੁੱਕੇ ਅਸੀਂ ਵਾਪਸ ਜਾ ਅੱਜ ਵਾਪਸ ਨੀਚੇ ਆਏ ਹਾਂ ਉਸ ਤੋਂ ਬਾਅਦ ਗਾਹਾਂ ਨੀਚੇ ਨੀਚੇ ਜਾਣਾ ਹੈ ਅਤੇ ਡੋਕਟਰ ਸਾਹਿਬ ਬਹੁਤ ਖੁਸ਼ ਹੋਏ ਉਨ੍ਹਾਂ ਨੇ ਮੇਰੀਆਂ ਦਵਾਈਆਂ ਚੈੱਕ ਕੀਤੀਆਂ ਅਤੇ ਦਵਾਈ ਖਾਣ ਤੋਂ ਕਹਿੰਦੇ ਫੇਰ ਘਬਰਾਉਣ ਦੀ ਤਾਂ ਗੱਲ ਹੀ ਨਹੀਂ ਵੀ ਬਹੁਤ ਵਧੀਆ ਹੋਇਆ ਤੁਸੀਂ ਦਰਸ਼ਨ ਕਰ ਆਉਂਦੇ ਅਤੇ ਜਾਓ ਅਤੇ ਜਾ ਕੇ ਦਵਾਈ ਖਾਓ ਅਤੇ ਸੌ ਜਾਉ ਅਰਾਮ ਨਾਲ ਐਸ਼ ਕਰੋ ਅਤੇ ਇਸ ਕਰਕੇ ਮੈਨੂੰ ਹੁਣ ਲੰਬਾ ਟਰੈਕ ਕਰਨ ਦੀ ਸੋਚਿਆ ਇਸ ਤੋਂ ਬਾਅਦ ਮੈਂ ਅਮਰਨਾਥ ਦੀ ਯਾਤਰਾ ਦੀ ਸਲਾਹ ਕੀਤੀ